ਮੇਰੀ ਮਨਪਸੰਦ ਗੇਮ ਪੈਟਲਗ੍ਰਾਊਡ ਮੋਬਾਈਲ ਹੈ ਇਹ ਇਕ ਔਨਲਾਈਨ ਗੇਮ ਹੈ ਇਸ ਦੇ ਵਿੱਚ ਆਪਾਂ ਦੋਸਤਾਂ ਨਾਲ ਜਾਂ ਇਕੱਲੇ ਇੱਕ ਮੈਚ ਲਗਾ ਸਕਦੇ ਹਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸੋ ਬੰਦੇ ਇੱਕ ਮੈਚ ਦੇ ਵਿੱਚ ਤੀਹ ਮਿੰਟ ਲਈ ਖੇਡਦੇ ਹਨ ਉਹ ਸੌ ਬੰਦਿਆਂ ਚੋਂ ਇੱਕ ਬੰਦਾ ਹੀ ਵਿਨਰ ਵਿਨਰ ਚਿਕਨ ਡਿਨ ਪਾਉਂਦਾ ਹੈ ਜਾਂ ਫਿਰ ਇੱਕ ਟੀਮ ਇਸ ਨੂੰ ਪਾਉਂਦੀ ਹੈ ਸੌ ਬੰਦਿਆ ਚੋਂ ਜਿੱਤਿਆ ਕਿਵੇਂ ਜਾਂਦਾ ਹੈ ਕਿ ਸਭ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਰਨਾ ਹੁੰਦਾ ਹੈ ਮਾਰਨ ਲਈ ਆਪਣੇ ਕੋਲ ਕੀ ਕੀ ਹੁੰਦਾ ਹੈ ਮੈਲੇ ਵੈਪਨਸ ਜਿਵੇਂ ਹਥਿਆਰ ਹੋ ਗਏ ਪੈਨ ਕੁਲਹਾੜੀ ਤਲਵਾਰ ਬੰਦੂਕਾਂ ਗਰਨੇਡਸ ਕਈ ਕੁਛ ਹੁੰਦਾ ਹੈ ਇਸ ਦੇ ਵਿੱਚ ਗੱਡੀਆਂ ਵੀ ਹੁੰਦੀਆਂ ਹਨ ਆਪਾਂ ਗੱਡੀ ਚੜਾ ਕੇ ਵੀ ਬੰਦਾ ਮਾਰ ਸਕਦੇ ਹਾਂ ਸਭ ਬੰਦਿਆਂ ਨੂੰ ਮਾਰਨ ਤੋਂ ਬਾਅਦ ਹੀ ਆਪਾਂ ਨੂੰ ਜਿੱਤ ਦਾ ਖਿਤਾਬ ਮਿਲਦਾ ਹੈ ਜਿਸ ਨੂੰ ਵਿਨਰ ਵਿਨਰ ਚਿਕਨ ਡਿਨਰ ਕਹਿੰਦੇ ਹਨ ਹੋਰ ਵੀ ਇਸ ਦੇ ਵਿੱਚ ਕਈ ਚੀਜ਼ਾਂ ਹਨ ਅਲੱਗ ਅਲੱਗ ਮੈਪਸ ਹਨ ਅਲੱਗ ਜਗਾਵਾਂ ਹਨ ਜਿਵੇਂ ਕਿ ਇਰੈਗਲ ਵਿੰਕਨਡੀ ਸ਼ੈਨਹੋਕ ਮਾ ਮਿਰਾਮਾਰ ਹੋਰ ਵੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੋਡਸ ਨੇ ਜੇ ਆਪਾਂ ਤੀਹ ਮਿੰਟ ਦਾ ਮੈਚ ਨਹੀਂ ਲਾਉਣਾ ਤਾਂ ਆਪਣੇ ਕੋਲ ਅੱਠ ਮਿੰਟ ਦਾ ਮੈਚ ਪੰਦਰਾਂ ਮਿੰਟ ਦਾ ਮੈਚ ਸਨਾਈਪਰ ਟ੍ਰੇਨਿੰਗ ਗਨ ਗੇਮ ਲਾਈਬਰੇਰੀ ਕਈ ਤਰਹਾਂ ਦੇ ਅਲੱਗ ਅਲੱਗ ਮੋਡਸ ਮਿਲਦੇ ਇਸ 'ਚ ਆਪਾਂ ਬੋਰ ਨਹੀਂ ਹੋ ਸਕਦੇ ਜੇ ਆਪਾਂ ਗੇਮ ਲਗਾ ਕੇ ਬੋਰ ਹਾਂ ਤਾ ਇਸ 'ਚ ਇਕ ਚੀਅਰ ਪਾਰਕ ਵੀ ਹੈ ਜਿਸ 'ਚ ਜਾ ਕੇ ਆਪਾਂ ਦੋਸਤਾਂ ਨਾਲ ਮਸਤੀ ਕਰ ਸਕਦੇ ਹਾਂ ਖੇਡ ਸਕਦੇ ਹਾਂ ਸਨੋਅ ਬੋਲ ਸੁੱਟ ਸਕਦੇ ਹਾਂ ਗੱਡੀਆਂ ਚਲਾ ਸਕਦੇ ਹਾਂ ਰੇਸਿਸ ਲਾ ਸਕਦੇ ਹਾਂ ਬਹੁਤ ਕੁਛ ਹੈ ਇਸ ਕਰਕੇ ਇਹ ਗੇਮ ਮੈਨੂੰ ਬਹੁਤ ਮਨ ਪਸੰਦ ਹੈ ਮੈ ਆਪਣੇ ਦੋਸਤਾਂ ਨਾਲ ਇਹ ਰੋਜ਼ ਖੇਡਦਾ ਹਾਂ